ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਦੀ ਸਾਜਣਾ ਤੇਰਾਂ ਅਪ੍ਰੈਲ ਸੋਲਾਂ ਸੌ ਨਿਨਆਣਵੇਂ ਵਿੱਚ ਕੀਤੀ ਸੀ ਗੁਰੂ ਗੋਬਿੰਦ ਸਿੰਘ ਜੀ ਸਿੱਖਾਂ ਦੇ ਦਸਵੇਂ ਗੁਰੂ ਸਨ ਉਹਨਾਂ ਨੇ ਖਾਲਸਾ ਪੰਥ ਦੀ ਸਥਾਪਨਾ ਇਸ ਕਰਕੇ ਕੀਤੀ ਸੀ ਤਾਂ ਕਿ ਮੁਸਲਮਾਨਾਂ ਦੇ ਅੱਤਿਆਚਾਰ ਤੋਂ ਲੋਕਾਂ ਨੂੰ ਬਚਾਇਆ ਜਾ ਸਕੇ ਅਤੇ ਇੱਕ ਕੌਮ ਤਿਆਰ ਕੀਤੀ ਜਾਵੇ ਜੋ ਸਮਾਂ ਪੈਣ 'ਤੇ ਲੋਕਾਂ ਨਾਲ ਜੋ ਕਿ ਲੜਾਈ ਕਰਦੇ ਸੀ ਉਹਨਾਂ ਨੂੰ ਰੋਕਿਆ ਜਾ ਸਕੇ ਇਸ ਤੋਂ ਸਿੱਖਾਂ ਦੇ ਵਿੱਚ ਆਪਸੀ ਭਾਈਚਾਰਾ ਵਧਿਆ ਅਤੇ ਉਹ ਮਿਲ ਜੁਲ ਕੇ ਲੜਾਈ ਲੜਦੇ ਸਨ